ਮੈਂ ਬਿਜਲੀ ਦਫਤਰ ਗਿਆ ਅਤੇ ਓਥਾਂ ਉਥੋਂ ਦੀ ਅਧਿਕਾਰੀਆਂ ਨੂੰ ਦੱਸਿਆ ਕਿ ਮੈਂ ਨਵੇਂ ਅਪਾਰਟਮੈਂਟ ਵਿੱਚ ਚਲਾ ਗਿਆ ਹਾਂ ਅਤੇ ਮੈਨੂੰ ਆਪਣੇ ਨਵੇਂ ਅਪਾਰਟਮੈਂਟ ਲਈ ਬਿਜਲੀ ਦੇ ਨਵੇਂ ਕਨੈਕਸ਼ਨ ਦੀ ਜ਼ਰੂਰਤ ਹੈ ਕਿਰਪਾ ਕਰਕੇ ਮੈਨੂੰ ਨਵਾਂ ਕਨੈਕਸ਼ਨ ਦੇ ਦਿੱਤਾ ਜਾਵੇ ਮੇਰਾ ਪਤਾ ਪਿੰਡ ਸੁਰੇਸ਼ ਵਾਲਾ ਸੈਣੀਆ ਹੈ ਜਿੱਥੇ ਮੈਂ ਹੁਣੇ ਨਵੀਂ ਜੁਆਇਨਿੰਗ ਕੀਤੀ ਹੈ ਅਤੇ ਇੱਥੇ ਮੈਨੂੰ ਇਹਲ ਇਲੈਕਟਰੀਸਿਟੀ ਦੀ ਜ਼ਰੂਰਤ ਹੈ ਇਸ ਲਈ ਮੈਨੂੰ ਬਿਜਲੀ ਦਾ ਨਵਾਂ ਕਨੈਕਸ਼ਨ ਦਿੱਤਾ ਜਾਵੇ